ਜੇ ਮੈਨੂੰ ਭਾਰਤ ਦੇ ਦਿਖਾਉਣ ਦਾ ਮੌਕਾ ਮਿਲੇ ਤਾਂ ਮੈਂ ਭਾਰਤ ਵਿੱਚ ਗੁਰੂ ਘਰਾਂ ਦੀਆਂ ਇਤਿਹਾਸਿਕ ਬਿਲਡਿੰਗਾਂ ਦੀਆਂ ਖੂਬਸੂਰਤੀ ਦੀਆਂ ਤਸਵੀਰਾਂ ਮੰਦਰਾਂ ਦੀਆਂ ਤਸਵੀਰਾਂ ਦਿੱਲੀ 'ਚ ਲਾਲ ਕਿਲੇ ਦੀਆਂ ਤਸਵੀਰਾਂ ਇੰਡੀਆ ਗੇਟ ਦੀਆਂ ਤਸਵੀਰਾਂ ਅਤੇ ਹੋਰ ਆਪਣਾ ਹਿਮਾਚਲ 'ਚ ਪਹਾੜੀ ਏਰੀਏ ਦੀਆਂ ਤਸਵੀਰਾਂ ਪਹਾੜ ਦੀਆਂ ਠੰਡੇ ਇਲਾਕੇ 'ਚ ਅਤੇ ਸ ਵਧੀਆ ਤਸਵੀਰਾਂ ਮਤਲਬ ਇਹ ਵੀ ਮੈਂ ਦਿਖਾਉਣ ਦਾ ਚਾਹਵਾਨ ਰਹੂੰਗਾ